ਹੈਲੋ ਹਾਂਜੀ ਨਨੀ ਮੈਮ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਮੈਮ ਮੈਂ ਘਰ ਆ ਗਈ ਹਾਂ ਮੈਂ ਡਾਇਟ ਪਲਾਨ ਤੁਹਾਡਾ ਰੈਡੀ ਕਰ ਦਿਆਂਗੀ ਮੈਮ ਤੁਸੀਂ ਦੁੱਧ ਵਧਵਾ ਤਾ ਸੀਗਾ ਜ਼ਿਆਦਾ ਤੁਸੀਂ ਫਿਰ ਕਹਿ ਦਿੰਦੇ ਹਾਂਜੀ ਮੈਮ ਮੈਮ ਡਾਕਟਰ ਨੂੰ ਪੁੱਛਣਾ ਸੀ ਵੀ ਨੋਨ ਵੈਜ ਕੇ ਵੈਜ ਤਾਂ ਕਰਨਾ ਉਸੇ ਅਕੋਰਡਿੰਗ ਫਿਰ ਮੈਂ ਤੁਹਾਡਾ ਡਾਇਟ ਪਲਾਨ ਸੈਟ ਕਰ ਦਾਂਗੀ ਹਾਂਜੀ ਹਾਂਜੀ ਮੈਮ ਫਿਰ ਸੁਬਹਾ ਮੈਮ ਤੁਸੀਂ ਬਨਾਨਾਸ ਵਗੈਰਾ ਲਈ ਮਤਲਬ ਫਰੂਟਸ ਕਰਵਾ ਲਿਓ ਅਤੇ ਉਸ ਤੋਂ ਬਾਅਦ ਤੁਹਾਨੂੰ ਸ਼ੇਕ ਦੇ ਦਿਆ ਕਰਾਂਗੀ ਹਾਂਜੀ ਹਾਂਜੀ ਅਤੇ ਮੈਮ ਤੁਸੀਂ ਹਾਂਜੀ ਮੈਮ ਹਾਂਜੀ ਮੈਮ ਮੈਂ ਚੈੱਕ ਕਰ ਕੇ ਤੁਹਾਨੂੰ ਦੱਸ ਦੀ ਹਾਂ ਮੈਮ ਇੱਕ ਤਾਂ ਸੋਇਆਬੀਨ ਲਈ ਆਇਓ ਜੇ ਇਕ ਚਨੇ ਲੈ ਆਇਓ ਇੱਕ ਤੁਸੀਂ ਮੈਮ ਫਰੂਟਸ ਲੈ ਆਇਓ ਬਨਾਨਾਸ ਲੈ ਆਇਓ ਐਪਲਸ ਲੈ ਆਇਓ ਠੀਕ ਹੈ ਨਹੀਂ ਮੈਮ ਨਹੀਂ ਆਇਆ ਸਰ ਦਾ ਫੋਨ ਨਹੀਂ ਆਇਆ ਮੈਨੂੰ ਹਾਂਜੀ ਮੈਮ ਮੈਂ ਹਾਂਜੀ ਮੈਮ ਕੋਈ ਗੱਲ ਨਹੀਂ ਰੁਕ ਜਾਵਾਂਗੀ ਓਕੇ ਮੈਮ ਉਹ ਤਾਂ ਕੋਈ ਗੱਲ ਨਹੀਂ ਮੈਂ ਕਰਦਾ ਕਿ ਤੁਸੀਂ ਮੈਮ ਸਾਰਾ ਸਮਾਨ ਲਿਆਓ ਫਿਰ ਮੈਂ ਉਸ ਅਕੋਰਡਿੰਗ ਤੁਹਾਨੂੰ ਬਣਾ ਕੇ ਦੇ ਦਿਆ ਕਰਾਂਗੀ ਕਿਉਂਕਿ ਜੇ ਸਮਾਨ ਨਾ ਹੋਇਆ ਫਿਰ ਕਿੱਦਾਂ ਨਹੀਂ ਨਹੀਂ ਮੈਮ ਮੇਰੇ ਲਈ ਤਾਂ ਕੁਝ ਨਹੀਂ ਮੈਂ ਕਹਿਣਾ ਮੈਮ ਜੂਸ ਵਗੈਰਾ ਲੈ ਆਇਓ ਨਾਲ ਤੁਸੀਂ ਠੀਕ ਹੈ ਮੈਮ ਠੀਕ ਹੈ ਉਹ ਤਾਂ ਕੋਈ ਗੱਲ ਨਹੀਂ ਹੋ ਜਾਏਗਾ ਹਾਂਜੀ ਮੈਮ ਮੈਮ ਤੁਸੀਂ ਜੂਸਸ ਵਗੈਰਾ ਦਾ ਅਰੇਂਜਮੈਂਟ ਕਰ ਲਿਓ ਕਿਉਂਕਿ ਜੂਸਸ ਵਗੈਰਾ ਖਤਮ ਹੋਏ ਹੋਏ ਆ ਅਤੇ ਬਾਜ਼ਾਰ ਦੇ ਵਿੱਚੋਂ ਵੀ ਸ਼ਾਇਦ ਹੀ ਮਿਲਣ ਅਤੇ ਤੁਸੀਂ ਕਿਤੋਂ ਹੋਰ ਅਰੇਂਜਮੈਂਟ ਕਰ ਲਿਓ ਜੇ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਹਾਂਜੀ ਮੈਮ ਫਿਰ ਜੰਕ ਫੂਡ ਤਾਂ ਬਿਲਕੁਲ ਹੀ ਬੰਦ ਕਰਦਾ ਨਾ ਮੈਮ ਓਲੀ ਖਾਣਾ ਤਾਂ ਬਿਲਕੁਲ ਹੀ ਬੰਦ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੁਣ ਤੁਸੀਂ ਕਿੰਨੇ ਕੁ ਵਜੇ ਤੱਕ ਆ ਜਾਉਂਗੇ ਠੀਕ ਹੈ ਠੀਕ ਹੈ ਮੈਮ ਓਕੇ ਓਕੇ ਮੈਮ ਧਿਆਨ ਨਾਲ ਆਓ ਓਕੇ ਓਕੇ